ਹਾਂਜੀ ਮਹਾਰਾਜ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਬਸ ਵਧੀਆ ਮੈਂ ਕਿਹਾ ਕਿੰਨਾ ਕੁ ਸਿਲੇਬਸ ਹੋ ਗਿਆ ਵਾ ਬਾਰਿਸ਼ ਬੁਰਿਸ਼ ਮੈਂ ਕਿਹਾ ਬਾਰਿਸ਼ ਕਰਕੇ ਛੁੱਟੀਆਂ ਬੜੀਆਂ ਹੋ ਗਈਆਂ ਤੇ ਕਿੰਨਾ ਕੁ ਸਿਲੇਬਸ ਹੋ ਗਿਆ ਥੋੜ੍ਹਾ ਹੋਇਆ ਜੇ ਫਿਰ ਕਿੱਦਾਂ ਕਵਰ ਕਰਨਾ ਬਾਰਿਸ਼ ਕਰਕੇ ਛੁੱਟੀਆਂ ਬੜੀਆਂ ਹੋ ਗਈਆਂ ਤਾਂ ਕਵਰ ਕਿੱਦਾਂ ਕਰਨਾ ਉਹਨੂੰ ਮੈਂ ਤਾਂ ਥੋੜ੍ਹਾ ਬਹੁਤ ਕਰ ਲਿਆ ਤੁਸੀਂ ਕਿੱਦਾਂ ਕਰਨਾ ਅੱਛਾ ਅੱਛਾ ਹਾਂ ਅਤੇ ਫਿਰ ਮੈਨੂੰ ਵੀ ਦੱਸ ਦਿਓ ਕਿੱਦਾਂ ਕਰਨਾ ਫਿਰ ਮੈਂ ਵੀ ਕਰਵਾ ਦਾਂਗਾ ਨਾ ਆਪਣੇ ਬੱਚਿਆਂ ਦਾ ਸਿਲੇਬਸ ਸਾਰਾ ਕੰਪਲੀਟ ਕਰਵਾਉਣਾ ਹੀ ਪੈਣਾ ਇਹ ਤਾਂ ਬੜਾ ਹਾਂਜੀ ਹਾਂਜੀ ਮੈਂ ਵੀ ਉਹੀ ਕਹਿ ਰਿਹਾ ਵੀ ਸਾਡੇ ਪ੍ਰੈਸ਼ਰ ਪੈਣਾ ਅਤੇ ਹੁਣ ਥੋੜ੍ਹਾ ਦੋ ਚਾਰ ਦਿਨਾਂ 'ਚ ਸਕੂਲ ਵੀ ਲੱਗ ਜਾਣੇ ਆ ਤਾਂ ਕਿੱਦਾਂ ਕਰਨਾ ਅੱਗੇ ਸਕੂਲ ਵੀ ਲੱਗਣ ਵਾਲਾ ਚਲੋ ਤੁਸੀਂ ਇੱਦਾਂ ਕਰਿਓ ਹਾਂ ਤੁਸੀਂ ਇੱਦਾਂ ਕਰੋ ਜਿੱਦਾਂ ਸਿਲੇਬਸ ਕੰਪਲੀਟ ਕਰੋਗੇ ਫਿਰ ਮੈਨੂੰ ਦੱਸ ਦਿਓ ਨਾ ਫਿਰ ਮੈਂ ਵੀ ਕਰ ਲੈਨਾ ਹੌਲੀ ਹੌਲੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਮੇਰਾ ਤਾਂ ਥੋੜ੍ਹਾ ਕੰਪਲੀਟ ਹੋ ਗਿਆ ਥੋੜ੍ਹਾ ਰਹਿ ਗਿਆ ਮੇਰਾ ਤਾਂ ਮੈਂ ਕਿਹਾ ਚਲੋ ਮੈਡਮ ਨੂੰ ਪੁੱਛਦਾ ਕਿੰਨਾ ਕੁ ਹੋਇਆ ਅਤੇ ਕਿੰਨਾ ਕੁ ਨਹੀਂ ਹਾਂਜੀ ਹਾਂਜੀ ਨਹੀਂ ਬਾਏ ਤਾਂ ਹੈ ਮੇਰੀ ਗੱਲ ਸੁਣੋ ਚਲੋ ਠੀਕ ਆ ਫਿਰ ਓ ਸਤਿ ਸ਼੍ਰੀ ਅਕਾਲ